ਹਾਂਜੀ ਸਰ ਤੁਸੀਂ ਟੂਰਿਸਟ ਗਾਈਡ ਬੋਲ ਰਹੇ ਹੋ ਫਾਜਿਲਕਾ ਤੋਂ ਸਰ ਤੁਹਾਡਾ ਨੰਬਰ ਮੇਰੀ ਇੱਕ ਫਰੈਂਡ ਨੇ ਦਿੱਤਾ ਸੀ ਅਤੇ ਮੈਂ ਇੱਥੇ ਫਾਜ਼ਿਲਕਾ ਘੁੰਮਣ ਆਈ ਹਾਂ ਅਤੇ ਇੱਥੇ ਕਿਹੜੀਆਂ ਘੁੰਮਣ ਵਾਲੀਆਂ ਜਗ੍ਹਾ ਹਨ ਸਰ ਆਉਣਾ ਹੈ ਅਭੀ ਠੀਕ ਹੈ ਸਰ ਸਰ ਇੱਥੇ ਰਹਿਣ ਲਈ ਕਿਹੜੇ ਕਿਹੜੇ ਹੋਟਲ ਵਧੀਆ ਹਨ ਅਤੇ ਸਰ ਇੱਥੇ ਕੈਬ ਦੀ ਸਹੂਲਤ ਹੈ ਠੀਕ ਹੈ ਸਰ ਸਰ ਜਦੋਂ ਅਸੀਂ ਇੱਥੇ ਆਵਾਂਗੇ ਤੁਹਾਨੂੰ ਜ਼ਰੂਰ ਕੌਲ ਕਰਾਂਗੇ ਧੰਨਵਾਦ ਜੀ